ਸਾਡੇ ਘਰ ਬਿਜਲੀ ਕਦੇ ਕਦੇ ਤਾਂ ਸਾਰਾ ਸਾਰਾ ਦਿਨ ਹੀ ਆਉਂਦੀ ਹੈ ਪਰ ਗਰਮੀਆਂ ਦੇ ਵਿੱਚ ਇਹਦੇ ਵਿੱਚ ਬੜੇ ਕੱਟ ਲੱਗਦੇ ਹਨ ਜੋ ਕਿ ਆਮ ਜ਼ਿੰਦਗੀ ਨੂੰ ਬੜੀ ਪ੍ਰਭਾਵਿਤ ਕਰਦੀ ਹੈ ਜਿਵੇਂ ਕੋਈ ਨਹਾਉਣ ਤੋਂ ਹੀ ਬੈਠਾ ਰਹਿੰਦਾ ਹੈ ਲਾਈਟ ਨਹਾਉਣ ਬੰਦਾ ਜਾਂਦਾ ਹੀ ਆ ਬਾਥਰੂਮ 'ਚ ਅਤੇ ਲਾਈਟ ਚੱਲ ਜਾਂਦੀ ਹੈ ਅਤੇ ਉਹ ਇੱਦਾਂ ਹੀ ਬਾਹਰ ਆ ਜਾਂਦਾ ਕਿਉਂਕਿ ਨਾਲ ਹੀ ਮੋਟਰ ਬੰਦ ਹੋ ਜਾਂਦੀ ਹੈ ਗਰਮੀ ਦੇ ਵਿੱਚ ਅਤੇ ਬਿਜਲੀ ਇੰਨੀ ਕੁ ਜਾਂਦੀ ਹੈ ਕਿ ਸਾਰਾ ਸਾਰਾ ਦਿਨ ਨਹੀਂ ਆਉਂਦੀ ਜੋ ਸਵੇਰੇ ਦਸ ਵਜੇ ਤੋਂ ਕੱਟ ਲੱਗਦਾ ਅਤੇ ਸ਼ਾਮੀ ਪੰਜ ਪੰਜ ਵਜੇ ਤੱਕ ਬੱਤੀ ਨਹੀਂ ਆਉਂਦੀ ਜਿਹਦੇ ਕਾਰਨ ਫਰਿੱਜ ਬੰਦ ਪੱਖੇ ਬੰਦ ਸਭ ਕੁਛ ਬੰਦ ਕਦੇ ਕਦੇ ਤਾਂ ਬਿਜਲੀ ਚੌਵੀ ਚੌਵੀ ਘੰਟੇ ਨਹੀਂ ਭੇਜਦੇ ਜਦੋਂ ਪਿੱਛੇ ਫਾਲਟ ਪੈ ਜਾਂਦਾ ਹੈ ਅਤੇ ਘਰ ਦੇ ਵਿੱਚ ਫਰਿੱਜ ਦੇ ਵਿੱਚ ਪਿਆ ਆਟਾ ਖਰਾਬ ਦੁੱਧ ਖਰਾਬ ਬੜਾ ਹੀ ਨੁਕਸਾਨ ਹੁੰਦਾ ਹੈ ਕਦੇ ਕਦੇ ਅਤੇ ਜ਼ਿੰਦਗੀ ਬਹੁਤ ਹੀ ਜ਼ਿਆਦਾ ਫਿਰ ਸਾਨੂੰ ਇੱਦਾਂ ਕਦੇ ਲੱਗਦੀ ਹੈ ਕਿ ਕੀ ਜ਼ਿੰਦਗੀ ਹੈ ਪਰ ਹੁਣ ਜਿੱਥੇ ਸੁੱਖ ਹੈ ਅਤੇ ਉਹਦੇ ਨਾਲ ਦੁੱਖ ਵੀ ਹੁੰਦੇ ਹੈ ਜਿੱਥੇ ਨੈਗਟਿਵ ਹੋਣ ਦੇ ਨਾਲ ਪੋਜੀਟਿਵ ਵੀ ਸਭ ਕੁਛ ਹੁੰਦਾ ਹੈ ਪਰ ਕਦੇ ਕਦੇ ਦੋ ਦੋ ਤਿੰਨ ਤਿੰਨ ਮਹੀਨੇ ਲਗਾਤਾਰ ਬਿਜਲੀ ਨਹੀਂ ਜਾਂਦੀ ਖਾਸ ਕਰਕੇ ਸਰਦੀਆਂ ਵਿੱਚ ਪਰ ਸਰਦੀਆਂ 'ਚ ਚਲੋ ਉਂਝ ਪੱਖੇ ਦੀ ਫਰਿੱਜ ਦੀ ਕੋਈ ਇੰਨੀ ਜ਼ਰੂਰਤ ਨਹੀਂ ਹੁੰਦੀ ਪਰ ਫਿਰ ਵੀ ਲਾਈਟ ਤਾਂ ਰਾਤ ਨੂੰ ਚਾਹੀਦੀ ਹੁੰਦੀ ਹੈ ਕਦੇ ਕਦੇ ਬੱਚੇ ਤਾਂ ਪੜ੍ਹਨ ਤੋਂ ਹੀ ਬੈਠੇ ਰਹਿੰਦੇ ਹਨ ਜਦੋਂ ਲਾਈਟ ਚਲ ਜਾਂਦੀ ਹੈ ਰਾਤੀ ਕਦੇ ਕਦੇ ਪੇਪਰ ਹੁੰਦੇ ਹੈ ਔਰ ਬੱਚੇ ਇੱਦਾਂ ਹੀ ਕੈਂਡਲ ਲਾਈਟ ਦੇ ਵਿੱਚ ਹੀ ਪੜ੍ਹਦੇ ਹਨ ਚਲੋ ਪਰ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਤਾਂ ਬਿਜਲੀ ਜੇ ਚਲ ਜਾਂਦੀ ਹੈ ਅਤੇ ਲੋਕਾਂ ਨੇ ਇਨਵਰਟਰ ਵੀ ਕਾਫੀ ਲਗਵਾ ਲਿੱਤੇ ਹੁਣ ਤਕਰੀਬਨ ਹਰ ਘਰ ਦੇ ਵਿੱਚ ਹੀ ਇਨਵਰਟਰ ਹਨ ਜਿਹਦੇ ਨਾਲ ਬਿਜਲੀ ਜਾਂਦੀ ਹੈ ਅਤੇ ਇਨਵੇਟਰ 'ਚ ਬੱਤੀ ਸਟੋਰੇਜ ਹੋਈ ਹੁੰਦੀ ਹੈ ਅਤੇ ਉਹ ਬੱਤੀ ਦੇ ਨਾਲ ਆਪਣਾ ਕੰਮ ਕਰ ਲੈਂਦੇ ਹਨ